ਹਾਂ ਅਸੀਂ ਇਹ ਚੰਗੇ ਤਰੀਕੇ ਨਾਲ ਮਹਿਸੂਸ ਕਰਦੇ ਹਾਂ ਕਿ ਜਿਹੜੀ ਡਾਕਟਰੀ ਦੇਖਭਾਲ ਹੈ ਉਹ ਅੱਛੀ ਤਰ੍ਹਾਂ ਨਾਲ ਨਹੀਂ ਹੋ ਸਕਦੀ ਗਰੀਬ ਲੋਕਾਂ ਦੇ ਲਈ ਗਰੀਬ ਲੋਕ ਇਸ ਲਈ ਆਪਣਾ ਇਲਾਜ ਨਹੀਂ ਕਰਵਾ ਸਕਦੇ ਕਿਉਂਕਿ ਉਹਨਾਂ ਕੋਲ ਇੰਨੇ ਪੈਸੇ ਹੀ ਨਹੀਂ ਹੁੰਦੇ ਜੇਕਰ ਉਹਨਾਂ ਕੋਲ ਇੰਨੇ ਪੈਸੇ ਹੋਣ ਤਾਂ ਉਹ ਡਾਕਟਰੀ ਇਲਾਜ ਚੰਗੀ ਤਰ੍ਹਾਂ ਕਰਵਾ ਲੈਣ ਗਰੀਬ ਲੋਕਾਂ ਦੇ ਲਈ ਡਾਕਟਰੀ ਇਲਾਜ ਕਰਵਾਉਣਾ ਇੱਕ ਬੜਾ ਹੀ ਕਠਿਨਾਈ ਵਾਲਾ ਕੰਮ ਹੈ ਜੇਕਰ ਗਰੀਬ ਲੋਕ ਆਪਣਾ ਇਲਾਜ ਕਰਵਾਉਣ ਲਈ ਕਿਸੇ ਹੋਰ ਜਗ੍ਹਾ ਜਾਂਦੇ ਹਨ ਤਾਂ ਉਹਨਾਂ ਕੋਲ ਐਨੇ ਪੈਸੇ ਹੀ ਨਹੀਂ ਹੁੰਦੇ ਹਨ ਗਰੀਬ ਲੋਕਾਂ ਲਈ ਪੇਂਡੂ ਖੇਤਰਾਂ ਲਈ ਸਿਹਤ ਸੇਵਾਵਾਂ ਲਈ ਅਸੀਂ ਇਹ ਕਹਿੰਦੇ ਹਾਂ ਆਪਣਾ ਸੁਝਾਅ ਇਹ ਦਿੰਦੇ ਹਾਂ ਇਹ ਗਰੀਬ ਲੋਕਾਂ ਅਤੇ ਪੇਂਡੂ ਖੇਤਰ ਦੇ ਲੋਕਾਂ ਲਈ ਸਿਹਤ ਸੇਵਾਵਾਂ ਨੂੰ ਪਹੁੰਚਾਉਣ ਲਈ ਮੇਰਾ ਇਹ ਸੁਝਾਅ ਹੈ ਕਿ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਸਮੇਂ ਸਮੇਂ ਸਿਰ ਹਰ ਬਿਮਾਰੀ ਨਾਲ ਸੰਬੰਧਿਤ ਕੈਂਪ ਇਹਨਾਂ ਖੇਤਰਾਂ ਵਿੱਚ ਲਗਾਏ ਜਾਣ ਤਾਂ ਜੋ ਪੇਂਡੂ ਖੇਤਰਾਂ ਨੂੰ ਇਹ ਸੇਵਾਵਾਂ ਮਿਲ ਸਕਣ ਅਤੇ ਉਹ ਆਪਣਾ ਇਲਾਜ ਚੰਗੇ ਤਰੀਕੇ ਨਾਲ ਕਰਵਾਉਣ ਜਦੋਂ ਉਹ ਆਪਣਾ ਇਲਾਜ ਚੰਗੇ ਤਰੀਕੇ ਨਾਲ ਕਰਵਾਉਣਗੇ ਤਾਂ ਉਹਨਾਂ ਨੂੰ ਬਹੁਤ ਹੀ ਚੰਗਾ ਲੱਗੇਗਾ ਮੇਰਾ ਇਹ ਸੁਝਾਅ ਤੁਹਾਡੇ ਅੱਗੇ ਰੱਖਿਆ ਹੈ